ਸਤਿ ਸ਼੍ਰੀ ਅਕਾਲ ਜੀ ਮੈਂ ਹਾਜੀ ਵਾਲਾ ਕਾਰਖਾਨਾ ਮੁਹੱਲਾ ਧਰਮਪੁਰਾ ਬੁਢਲਾਡਾ ਵਿਖੇ ਰਹਿੰਦੀ ਹਾਂ ਅਤੇ ਮੇਰੇ ਘਰ ਦੇ ਨੇੜੇ ਇੱਕ ਗੁਰਦੁਆਰਾ ਹੈ ਗੁਰਦੁਆਰਾ ਭਾਈ ਜਗਤਾ ਜੀ ਇੱਥੇ ਰੋਜ਼ ਹੀ ਕੀਰਤਨ ਹੁੰਦਾ ਹੈ ਅਤੇ ਇੱਥੇ ਮੁਹੱਲੇ ਦੀਆਂ ਬੀਬੀਆਂ ਦੀ ਇੱਕ ਸਭਾ ਵੀ ਬਣੀ ਹੋਈ ਹੈ ਜਿਹਦਾ ਨਾਂ ਹੈ ਬੀਬੀ ਭਾਨੀ ਜੀ ਇਸਤਰੀ ਸਤਿਸੰਗ ਸਭਾ ਇਹ ਬੀਬੀਆਂ ਜਾਂ ਤਾਂ ਗੁਰਪੁਰਬ ਦੇ ਉੱਪਰ ਜਾਂ ਕਿਸੇ ਖਾਸ ਮੌਕੇ ਦੇ ਉੱਪਰ ਜਾਂ ਨਹੀਂ ਤਾਂ ਮਹੀਨਾਵਾਰ ਕਿਸੇ ਨਾ ਕਿਸੇ ਘਰ ਜਿਸ ਦੇ ਘਰ ਵੀ ਪਾਠ ਹੁੰਦਾ ਉੱਥੇ ਜਾ ਕੇ ਕੀਰਤਨ ਕਰਦੀਆਂ ਹਨ ਇਹ ਆਪਣੇ ਕੀਰਤਨ ਦੇ ਵਿੱਚ ਜ਼ਿਆਦਾਤਰ ਹਾਰਮੋਨੀਅਮ ਦੀ ਵਰਤੋਂ ਕਰਦੀਆਂ ਹਨ ਹਾਰਮੋਨੀਅਮ ਦੀ ਵਰਤੋਂ ਹਾਰਮੋਨੀਅਮ ਦੇ ਉੱਪਰ ਸ਼ਬਦ ਗਾਉਂਦੀਆਂ ਨੇ ਜਾਂ ਉਸ ਦੇ ਨਾਲ ਇਹ ਢੋਲਕੀ ਦੀ ਵਰਤੋਂ ਵੀ ਕਰਦੀਆਂ ਹਨ ਜ਼ ਜੋ ਕੀਰਤਨ ਨੂੰ ਲੈਅ ਦਿੰਦੀ ਹੈ ਤਾਲ ਦਿੰਦੀ ਹੈ ਇਸ ਤੋਂ ਇਲਾਵਾ ਚਿਮਟੇ ਅਤੇ ਸ਼ੈਣੇ ਨੇ ਸੰਗੀਤ ਦੇ ਇਹੀ ਯੰਤਰ ਹੈ ਜਿਹੜੇ ਮੈਂ ਵਰਤੇ ਜਾਂਦੇ ਹੋਏ ਦੇਖੇ ਨੇ ਆਪਣੇ ਆਸ ਪਾਸ ਇਸ ਤੋਂ ਇਲਾਵਾ ਹੋਰ ਜਿਹੜੀਆਂ ਆਧੁਨਿਕ ਯੰਤਰ ਨੇ ਸੰਗੀਤ ਦੇ ਉਹ ਸਾਡੇ ਮੁਹੱਲੇ ਦੇ ਵਿੱਚ ਨੇੜੇ ਹਾਲੇ ਮੌਜੂਦ ਨਹੀਂ ਹਨ ਧੰਨਵਾਦ